ਦਰਅਸਲ ਮੈਂ ਐਮਾਜ਼ੋਨ 'ਤੇ ਇੱਕ ਮੋਬਾਈਲ ਫੋਨ ਦਾ ਓਡਰ ਦਿੱਤਾ ਸੀ ਜਿਸ ਨੂੰ ਦੇਣ ਤੋਂ ਬਾਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਗਲਤ ਮੋਬਾਈਲ ਦਾ ਓਡਰ ਦੇ ਦਿੱਤਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫੋਨ ਹਲੇ ਤੱਕ ਡਿਸਪੈਚ ਨਹੀਂ ਹੋਇਆ ਹੈ ਜਿਸ ਕਰਕੇ ਮੈਂ ਉਸ ਓਡਰ ਨੂੰ ਰੱਦ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਉਹ ਮੋਡਲ ਨਹੀਂ ਦਰਅਸਲ ਕੋਈ ਹੋਰ ਮੋਡਲ ਚਾਹੀਦਾ ਹੈ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਮੇਰਾ ਓਡਰ ਕੈਂਸਲ ਕਰਕੇ ਮੇਰੀ ਮਦਦ ਕਰੋ ਤਾਂ ਕਿ ਮੈਂ ਆਪਣਾ ਦੂਜਾ ਮੋਬਾਈਲ ਮੋਡਲ ਓਡਰ ਕਰ ਸਕਾਂ ਧੰਨਵਾਦ